ਸ਼ੇਅਰ ਮਾਰਕਿਟ ਇੱਕ ਇੰਟਰਨੈਸ਼ਨਲ ਬਜ਼ਾਰ ਹੈ ਇਹਦੇ ਵਿੱਚ ਵੱਖ ਵੱਖ ਕੰਪਨੀਆਂ ਦੇ ਟਰੇਡਸ ਵੇਚਦੀਆਂ ਹਨ ਅਤੇ ਹਰੇਕ ਟਰੇਡਸ ਹਰੇਕ ਕੰਪਨੀ ਕੋਈ ਟਰੇਡਸ ਨੂੰ ਘੱਟ ਮੁੱਲ ਅਤੇ ਵੱਧ ਮੁੱਲ ਵਿੱਚ ਵੇਚਦੀਆਂ ਹਨ ਵਿਅਕਤੀ ਇਹ ਸ਼ੇਅਰ ਮਾਰਕੀਟ ਵਿੱਚੋਂ ਟਰੇਡਸ ਨੂੰ ਘੱਟ ਰੁਪਏ ਵਿੱਚ ਖਰੀਦ ਕੇ ਵੱਧ ਰੇਟ ਵਿੱਚ ਵੇਚ ਸਕਦਾ ਹੈ ਇਸ ਨਾਲ ਵਿਅਕਤੀ ਨੂੰ ਮੁਨਾਫਾ ਵੀ ਹੁੰਦਾ ਹੈ ਅਤੇ ਘਾਟਾ ਵੀ ਪੈ ਸਕਦਾ ਹੈ ਟਰੇਡਸ ਖ ਟਰੇਡਸ ਨੂੰ ਲੋਅ ਪਰਾਈਜ਼ ਉਥੇ ਖਰੀਦ ਕੇ ਅਤੇ ਵੱਧ ਪ੍ਰਾਈਜ਼ 'ਤੇ ਸੇਲ ਕੀਤੇ ਜਾਂਦੇ ਹੈ